ਪੰਜਾਬੀ ਭਾਸ਼ਾ ਨੇ ਸਾਡੇ ਸੱਭਿਆਚਾਰ ਅਤੇ ਪਹਿਚਾਣ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਪੰਜਾਬੀ ਭਾਸ਼ਾ ਪੰਜਾਬੀ ਪਹਿਰਾਵਾ ਅਤੇ ਪੰਜਾਬੀ ਸੱਭਿਆਚਾਰ ਕਾਰਨ ਹੀ ਸਾਡੀ ਪਹਿਚਾਣ ਪੂਰੀ ਦੁਨੀਆ ਵਿੱਚ ਵੱਖਰੀ ਹੈ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਭਾਸ਼ਾ ਹੈ ਸਾਡੀ ਭਾਸ਼ਾ ਵਿੱਚੋਂ ਹੀ ਸਾਡੇ ਦਰਿਆ ਦਿਲ ਅਤੇ ਸੁਭਾਅ ਵਿੱਚ ਖੁੱਲ੍ਹੇ ਪਣ ਹੋਣ ਦਾ ਪਤਾ ਲਗਦਾ ਹੈ ਵੱਡਿਆਂ ਦਾ ਆਦਰ ਅਤੇ ਛੋਟਿਆਂ ਨਾਲ ਪਿਆਰ ਅਤੇ ਜ਼ੁਲਮ ਦੇ ਅੱਗੇ ਝੁਕਣ ਦੀ ਬਜਾਏ ਉਸ ਦਾ ਡੱਟ ਕੇ ਵਿਰੋਧ ਕਰਨ ਦਾ ਗੁਣ ਸਾਨੂੰ ਸਾਡੇ ਸੱਭਿਆਚਾਰ ਵਿੱਚੋਂ ਹੀ ਮਿਲਦਾ ਹੈ